ਹੈਲੋ ਸਤਿ ਸ਼੍ਰੀ ਅਕਾਲ ਵੀਰ ਜੀ ਅੱਛਾ ਜੀ ਦੱਸੋ ਅੱਛਾ ਜੀ ਅੱਛਾ ਜੀ ਅੱਛਾ ਜੀ ਪੰਜਾਬ ਦਾ ਤਾਂ ਵੈਸੇ ਸਭ ਤੋਂ ਵਧੀਆ ਫੂਡ ਮੱਕੀ ਦੀ ਰੋਟੀ ਅਤੇ ਸਾਗ ਹੀ ਹੈ ਵੈਸੇ ਤਾਂ ਸਾਗ ਨੂੰ ਪੰਜਾਬੀ 'ਚ ਹਰਾ ਸੋਨਾ ਹੀ ਕਿਹਾ ਜਾਂਦਾ ਕਿਉਂਕਿ ਇਹਦੇ ਵਿੱਚ ਬਹੁਤ ਕੁਝ ਪੈਂਦਾ ਪਾਲਕ ਮੇਥੇ ਬਾਥੂ ਧਨੀਆ ਸਾਰਾ ਕੁਝ ਚੰਗੀ ਤਰ੍ਹਾਂ ਸਾਫ਼ ਕਰਕੇ ਫਿਰ ਇਹਦੇ 'ਚ ਅੱਲ੍ਹਣ ਪਾ ਕੇ ਦੋ ਤਿੰਨ ਘੰਟੇ ਚੰਗੀ ਤਰ੍ਹਾਂ ਰਿਝਾਇਆ ਜਾਂਦਾ ਇਹਨੂੰ ਫਿਰ ਇਹ ਮੱਖਣ ਪਾ ਕੇ ਜਦ ਖਾਧਾ ਜਾਂਦਾ ਬਹੁਤ ਹੀ ਸਵਾਦ ਲੱਗਦਾ ਇਹ ਅਤੇ ਨਾਲ਼ ਲੱਸੀ ਇਹਦਾ ਬਹੁਤ ਵਧੀਆ ਟੇਸਟ ਆਉਂਦਾ ਮੱਕੀ ਦੀ ਰੋਟੀ ਸਰ੍ਹੋਂ ਦਾ ਸਾਗ ਲੱਸੀ ਅਤੇ ਮਿੱਠੀਆਂ ਚੀਜ਼ਾਂ ਵਿੱਚ ਗਾਜਰਪਾਕ ਬਹੁਤ ਵਧੀਆ ਬਣਦਾ ਇੱਥੇ ਜਲੇਬੀਆਂ ਸ਼ਾਹੀ ਪਨੀਰ ਦਾਲ ਮੱਖਣੀ ਬਹੁਤ ਸਾਰੀਆਂ ਆਈਟਮਾਂ ਨਾਨ ਛੋਲੇ ਬਹੁਤ ਵਧੀਆ ਬਣਦੇ ਨੇ ਹਾਂਜੀ ਆਲ੍ਹਣ ਹੁੰਦਾ ਵੀ ਜਦੋਂ ਸਾਗ ਰਿਝ ਜਾਂਦਾ ਕਾਫ਼ੀ ਦੇਰ ਰਿੰਨ੍ਹਣ ਤੋਂ ਬਾਅਦ ਅਤੇ ਉਹ 'ਚ ਅਸੀਂ ਕੱਚੇ ਮਸਾਲੇ ਵੀ ਰਿੰਨ੍ਹ ਲੈਂਦੇ ਆ ਫਿਰ ਉਹਦੇ 'ਚ ਮੱਕੀ ਦੇ ਆਟੇ ਦਾ ਥੋੜ੍ਹਾ ਜਿਹਾ ਉਹਨੂੰ ਵਿੱਚ ਥੋੜ੍ਹਾ ਥੋੜ੍ਹਾ ਕਰਕੇ ਪਾ ਕੇ ਵੀ ਸਾਗ 'ਚ ਗੱਠਾਂ ਨਾ ਬਣਨ ਉਹਨੂੰ ਘੋਟਣੇ ਨਾਲ਼ ਘੋਟਿਆ ਜਾਂਦਾ ਫਿਰ ਉਹਦੇ ਨਾਲ਼ ਉਹ ਫਿਰ ਮੱਕੀ ਦੇ ਆਟੇ ਨੂੰ ਵਿੱਚ ਰਲਾਣ ਨੂੰ ਜਿਹੜਾ ਹੁੰਦਾ ਉਹਨੂੰ ਆਲ੍ਹਣ ਕਹਿੰਦੇ ਨੇ ਅਤੇ ਉਹਨੂੰ ਮਿਕਸ ਕਰਕੇ ਫਿਰ ਉਹ ਸਾਗ ਬਣਦਾ ਉਹ ਤੋਂ ਬਾਅਦ ਥੋੜ੍ਹਾ ਸਾਗ ਸਿਜਦਾ ਸਿਜਦੇ ਦਾ ਮਤਲਬ ਵੀ ਉਹ ਜ਼ਿਆਦਾ ਸਾਗ ਆਟਾ ਵਿੱਚ ਕੱਚਾ ਨਾ ਰਹਿ ਜਾਵੇ ਉਹਦਾ ਕੱਚੇ ਦਾ ਸਵਾਦ ਨਾ ਆਵੇ ਫਿਰ ਉਹਨੂੰ ਥੋੜ੍ਹਾ ਦੇਰ ਹੋਰ ਰਿੰਨ੍ਹਿਆ ਜਾਂਦਾ ਸਵਾਦ ਬਣਾਉਣ ਵਾਸਤੇ ਹਾਂਜੀ ਹਾਂਜੀ ਹਾਂਜੀ ਉਹ ਤਾਂ ਆਪਣੀ ਮਰਜ਼ੀ ਹੈ ਵੀ ਕਿਸੇ ਨੂੰ ਕਣਕ ਦੀ ਰੋਟੀ ਖਾਣੀ ਪਸੰਦ ਹੁੰਦੀ ਸਾਗ ਨਾਲ਼ ਤਾਂ ਕਿਸੇ ਨੂੰ ਮੱਕੀ ਦੀ ਪਰ ਇਹਦੇ ਨਾਲ਼ ਮੱਕੀ ਦੀ ਹੀ ਜ਼ਿਆਦਾ ਪਸੰਦ ਕਰਦੇ ਨੇ ਪੰਜਾਬੀ ਨਹੀਂ ਨਹੀਂ ਨਹੀਂ ਨਹੀਂ ਇਹ ਤਾਂ ਆਟੇ 'ਤੇ ਡਿਪੈਂਡ ਕਰਦਾ ਅਗਰ ਆਟਾ ਵਧੀਆ ਤਾਂ ਰੋਟੀ ਵੀ ਬਹੁਤ ਮੁਲਾਇਮ ਹੁੰਦੀ ਹੈ ਲੱਸੀ ਪਾਚਨ 'ਚ ਮਦਦ ਕਰਦੀ ਹੈ ਖਾਣੇ ਦੇ

ਹਾਂਜੀ ਹਾਂਜੀ ਹਾਂਜੀ ਜਦੋਂ ਤੁਸੀਂ ਸਾਡੇ ਸ਼ਹਿਰ ਆਉਂਗੇ ਅਸੀਂ ਤੁਹਾਨੂੰ ਜ਼ਰੂਰ ਇਹ ਸਭ ਖਿਲਾਵਾਂਗੇ ਓਕੇ ਜੀ ਥੈਂਕ ਯੂ ਸਤਿ ਸ਼੍ਰੀ ਅਕਾਲ